ਰਾ ਜਿਸ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਨੇ ਦੀਵਾਲੀ ਦੀਵਾਲੀ ਨੂੰ ਘਰ ਲੋਕ ਪਹਿਲਾਂ ਘਰ ਦੀਆਂ ਸਜਾਵਟ ਘਰ ਦੀਆਂ ਸਫ਼ਾਈਆਂ ਕਰਦੇ ਨੇ ਕਾਫ਼ੀ ਦਿਨ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦਾ ਹੈ ਦੀਵਾਲੀ ਸਜਾਵ ਉਸ ਤੋਂ ਬਾਅਦ ਸਜਾਵਟ ਕੀਤੀ ਜਾਂਦੀ ਹੈ ਮਠਿਆਈਆਂ ਲੱਗ ਜਾਂਦੀਆਂ ਬਾਜ਼ਾਰ ਬਹੁਤ ਰੌਣਕ ਹੁੰਦੀ ਹੈ ਦੀਵਾਲੀ ਵਾਲੇ ਦਿਨ ਲੋਕ ਦੀਵਾਲੀ ਵਾਲੇ ਦਿਨ ਸਵੇਰੇ ਉੱਠ ਕੇ ਪਹਿਲਾਂ ਲੋਕ ਪੂਜਾ ਕਰਦੇ ਨੇ ਮੱਥਾ ਟੇਕਦੇ ਗੁਰੂ ਘਰਾਂ ਵਿੱਚ ਜਾ ਕੇ ਜੋ ਪੂਜਾ ਕਰਦੇ ਨੇ ਉਸ ਤੋਂ ਬਾਅਦ ਵਿੱਚ ਲੋਕ ਸ਼ਾਮ ਦੇ ਟਾਈਮ ਆਪਣੇ ਘਰ ਨੂੰ ਕ ਕੈ ਦੀਵੇ ਦ ਦੀਵੇ ਮੋਮਬੱਤੀਆਂ ਜਗਾ ਕੇ ਰੋਸ਼ਨ ਕਰਦੇ ਨੇ ਤ ਕਈ ਥਾਵਾਂ 'ਤੇ ਦੀਪਮਾਲਾ ਕੀਤੀ ਜਾਂਦੀ ਹੈ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਨੇ ਆਲੇ ਦੁਆਲੇ ਆਂਢ ਗੁਆਂਢ ਵਿੱਚ ਚਾਹੇ ਰਿਸ਼ਤੇਦਾਰੀ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਇੱਕ ਪਿਆਰ ਦਾ ਤਿਉਹਾਰ ਹੈ ਇਹਨੂੰ ਵਧੀਆ ਤਰੀਕੇ ਨਾਲ ਹੀ ਮਨਾਉਣਾ ਚਾਹੀਦਾ ਹੈ ਦੀਵਾਲੀ ਵਾਲੇ ਦਿਨ ਸ਼ਾਮ ਨੂੰ ਲੋਕ ਆਤਿਸ਼ਬਾਜ਼ੀ ਵੀ ਕਾਫ਼ੀ ਚਲਾਉਂਦੇ ਨੇ ਜਿਸਦਾ ਕਿ ਕਈ ਤਰ੍ਹਾਂ ਦੇ ਪਟਾਕੇ ਲਿਆਂਦੇ ਜਾਂਦੇ ਨੇ ਮਾਰਕੀਟ ਵਿੱਚ ਕਈ ਦਿਨ ਪਹਿਲਾਂ ਹੀ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੈ ਦੀਵਾਲੀ ਮੇਰਾ ਮਨਪਸੰਦ ਤਿਉਹਾਰ ਹੈ ਉਸਤੋਂ ਇਹ ਵਿਸਾਖ ਵਿਸਾਖ ਵਿਸਾਖੀ ਵਾਲੇ ਮਹੀਨੇ ਦੇ ਤੇਰ੍ਹਾਂ ਤਰੀਕ ਨੂੰ ਹੀ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਲੋਕ ਇਸ ਨੂੰ ਫ਼ਸ ਕਣਕ ਪੱਕਣ ਦੀ ਖੁਸ਼ੀ ਵਿੱਚ ਮਨਾਉਂਦੇ ਹਨ ਅਤੇ ਇਸ ਦਿਨ ਲੋਕ ਆਪਣੇ ਕਣਕ ਦੀ ਵਾਢੀ ਨੂੰ ਸ਼ੁਰੂ ਕਰ ਦਿੰਦੇ ਹਨ ਇਸ ਦਿਨ ਆਨੰਦਪੁਰ ਸਾਹਿਬ ਵਿੱਚ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਇਸ ਤਰ੍ਹਾਂ ਸਿੱਖ ਖਾਲਸਾ ਪੰਥ ਦੀ ਨੀਂਹ ਰੱਖੀ ਗਈ ਇੱਕ ਇੱਕ ਵਿਸਾਖ ਦੇ ਮਹੀਨੇ ਵੀ ਲੋਕ ਬਹੁਤ ਸਾਰੇ ਘਰ ਵਿੱਚ ਪਕਵਾਨ ਬਣਾਉਂਦੇ ਨੇ ਬਹੁਤ ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ ਜਾਂਦੀਆਂ ਨੇ ਇਹ ਇੱਕ ਸਿੱਖਾਂ ਦਾ ਪ੍ਰਚਲਿਤ ਤਿਉਹਾਰ ਹੈ ਕ੍ਰਿਸ਼ਮਿਸ਼ ਕ੍ਰਿਸ਼ਮਿਸ਼ ਵਾਲੇ ਦਿਨ ਇਸ ਦਿਨ ਜਿਸ ਉੱਪ ਇਹ ਪੱਚੀ ਦਸੰਬਰ ਨੂੰ ਮਨਾਇਆ ਜਾਂਦਾ ਇਸ ਦਿਨ ਯਿਸ਼ੂ ਮਸੀਹ ਜੀ ਦਾ ਜਨਮਦਿਨ ਹੁੰਦਾ ਹੈ ਉਸ ਦਿਨ ਲੋਕ ਬਹੁਤ ਸਾਰੀ ਸਜਾਵਟ ਕਰਦੇ ਨੇ ਬਹੁਤ ਸਾਰੇ ਪਕਵਾਨ ਇੱਕ ਦੂਜੇ ਨੂੰ ਮਿਲਦੇ ਨੇ ਗਲੇ ਪ੍ਰਭਾਤ ਫੇਰੀਆਂ ਨਿਕਲੀਆਂ ਜਾਂਦੀਆਂ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਇਸ ਦਿਨ ਲੋਕ ਬਹੁਤ ਖੁਸ਼ ਹੁੰਦੇ ਨੇ ਕਈ ਪ੍ਰਕਾਰ ਦੇ ਭੋਜਨ ਪਕਵਾਨ ਬਣਾ ਕੇ ਹੀ ਇੱਕ ਦੂਜੇ ਦੇ ਗਲੇ ਮਿਲਦੇ ਹਨ ਇਸ ਤਰ੍ਹਾਂ ਇਹ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਸਿੱਖਾਂ ਕਈ ਤ ਸਾਰੇ ਧਰਮਾਂ ਦੇ ਤਿਉਹਾਰ ਬਹੁਤ ਵਧੀਆ ਹੁੰਦੇ ਨੇ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਹੀ ਮਨਾਉਣੇ ਚਾਹੀਦੇ ਹਨ